ਉਵੇਂ ਤਾਂ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਆਵਾਜਾਈ ਦੇ ਵਿਕਲਪ ਹਨ ਜਿਵੇਂ ਕਿ ਪੀ ਆਰ ਸੀ ਟੀ ਸੀ ਬੱਸਾਂ ਕੈਬਸ ਆਟੋ ਆਦਿ ਬਟ ਜੇਕਰ ਗੱਲ ਕੀਤੀ ਜਾਵੇ ਪੀ ਆਰ ਸੀ ਟੀ ਸੀ ਬੱਸਾਂ ਤਾਂ ਇਹ ਆਮ ਜਨਤਾ ਨੂੰ ਬਹੁਤ ਹੈਲਪ ਕਰਦੀਆਂ ਨੇ ਮਤਲਬ ਮਦਦ ਕਰਦੀਆਂ ਨੇ ਆਪਾਂ ਜਿਵੇਂ ਆਪਣੇ ਕੋਲੇਜ ਜਾਣਾ ਸਕੂਲ ਜਾਣ ਤਾਂ ਆਪਾਂ ਬੱਸਾਂ ਦੀ ਹੈਲਪ ਲੈ ਸਕਦੇ ਹਾਂ ਕੁਝ ਕੁਝ ਜੋ ਬੰਦਿਆਂ ਦੀ ਜਿਹੜੀ ਡਿਊਟੀ ਲੱਗੀ ਹੁੰਦੀ ਉਹ ਆਪਣੇ ਸ਼ਹਿਰ ਤੋਂ ਬਾਹਰ ਵੀ ਲੱਗੀ ਹੁੰਦੀ ਆ ਅਤੇ ਜੇਕਰ ਆਪਾਂ ਬੱਸਾਂ ਵਗੈਰਾ ਦਾ ਯੂਜ ਅ ਕਰਦੇ ਹਾਂ ਤਾਂ ਫਿਰ ਆਪਾਂ ਆਪਣੇ ਜੋਬ ਵਗੈਰਾ 'ਤੇ ਈਜ਼ੀਲੀ ਪਹੁੰਚ ਸਕਦੇ ਹਾਂ ਅਤੇ ਅ ਮਤਲਬ ਇਹ ਘੱਟ ਫੇਅਰ 'ਤੇ ਸਾਨੂੰ ਮਿਲ ਜਾਂਦੀਆਂ ਆ ਆਮ ਆਮ ਜਨਤਾ ਨੂੰ ਮਤਲਬ ਇਹਨੂੰ ਅਵੇਲ ਕਰ ਸਕਦੀ ਆ ਆਮ ਜਨਤਾ ਇਹ 'ਤੇ ਜਾ ਸਕਦੀ ਆ ਅਤੇ ਸਾਨੂੰ ਬਹੁਤ ਹੀ ਹੈਲਪ ਕਰਦੀ ਜਿਵੇਂ ਆਟੋ ਵਗੈਰਾ ਵੀ ਹੈ ਨੇ ਅਤੇ ਰਿਕਸ਼ੇ ਵਗੈਰਾ ਅਤੇ ਆਟੋ ਵਗੈਰਾ 'ਤੇ ਆਪਾਂ ਲਾਗੇ ਛਾਗੇ ਦੀ ਲੋਕੇਸ਼ਨਾਂ 'ਤੇ ਜਾ ਸਕਦੇ ਹਾਂ ਜਿਵੇਂ ਆਪਾਂ ਘਰ ਤੋਂ ਥੋੜ੍ਹੀ ਦੂਰ 'ਤੇ ਜਾਣਾ ਆ ਅਤੇ ਆਪਾਂ ਆਪਣੇ ਆਪਣੇ ਵਹੀਕਲ ਨਾ ਯੂਜ ਕਰਦੇ ਹੋਏ ਦੂਜਿਆਂ ਦੀ ਬਾਈਕ ਮਤਲਬ ਆਮ ਆਮ ਵਹੀਕਲ ਯੂਜ ਕਰੀਏ ਅਤੇ ਉਹ ਆਪਣੇ ਵਾਸਤੇ ਲਾਭਦਾਇਕ ਆ ਉਹ ਨਾਲ ਟਾਈਮ ਵੀ ਬਚਦਾ ਅਤੇ ਫੋਸਿਲ ਫਿਊਲ ਵੀ ਬਚਦੇ ਨੇ